ਕਾਰੋਬਾਰ ਸ਼ੁਰੂ ਕਰਦੇ ਸਮੇਂ ਪੇਂਡੂ ਲੋਕਾਂ ਨੂੰ ਸਭ ਤੋਂ ਪਹਿਲਾਂ ਤਾਂ ਇਸ ਚੁਣੌਤੀ ਦਾ ਸਾਹਮਣਾ ਕਰਨਾ ਪੈਂਦਾ ਕਿ ਉਹਨਾਂ ਨੂੰ ਜਾਣਕਾਰੀ ਬਹੁਤ ਘੱਟ ਹੁੰਦੀ ਹੈ ਜਦੋਂ ਕੋਈ ਚੀਜ਼ ਸ਼ੁਰੂ ਕਰਦੇ ਹਨ ਤਾਂ ਉਹ ਸਿੰਪਲ ਤਰੀਕੇ ਨਾਲ ਕਰਦੇ ਅਤੇ ਉਨ੍ਹਾਂ ਨੂੰ ਕੋਈ ਪ੍ਰੋਫੈਸ਼ਨਲ ਜਾਣਕਾਰੀ ਨਹੀਂ ਹੁੰਦੀ ਆ ਜਾਂ ਉਹਨੂੰ ਕੋਈ ਜਾਣਕਾਰੀ ਦੇਣ ਵਾਲਾ ਨਹੀਂ ਹੁੰਦਾ ਇਸ ਲਈ ਜਿਹੜੀ ਸਰਕਾਰ ਨੂੰ ਏ ਪਿੰਡ ਪਿੰਡਾਂ ਵਿੱਚ ਜਿਹੜੇ ਕਿ ਕੈਂਪ ਲਗਾਏ ਲਗਾਉਣੇ ਚਾਹੀਦੇ ਹਨ ਤਾਂ ਜੋ ਵੀ ਉਹਨਾਂ ਨੂੰ ਇਹ ਇਹਨਾਂ ਚੁਣੌਤੀਆਂ ਸਾਹਮਣਾ ਪੇਂਡੂ ਲੋਕਾਂ ਨੂੰ ਨਾ ਕਰਨਾ ਪਵੇ ਅਤੇ ਪੇਂਡੂ ਲੋਕਾਂ ਨੂੰ ਸਭ ਤੋਂ ਵੱਡੀ ਗੱਲ ਹੈ ਜਿਹੜੀ ਕਿ ਪੂੰਜੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ ਕਿਉਂਕਿ ਉਹਨਾਂ ਕੋਲ ਜ਼ਮੀਨ ਤਾਂ ਹੁੰਦੀ ਹੋਈ ਆ ਬਟ ਉਹਨਾਂ ਨੂੰ ਜਿਹੜੀ ਕੀ ਹੈ ਪੂੰਜੀ ਦੀ ਲੋੜ ਹੁੰਦੀ ਆ ਤਾਂ ਸਰਕਾਰ ਨੂੰ ਹੈ ਜੋ ਕਿ ਉਹਨਾਂ ਨੂੰ ਕਰਜ਼ੇ ਹੈ ਕਰਜ਼ਾ ਦੇਣਾ ਚਾਹੀਦਾ ਤਾਂ ਜੋ ਕਰਜ਼ਾ ਵੀ ਉਹਨਾਂ ਨੂੰ ਘੱਟ ਵਿਆਜ 'ਤੇ ਦੇਣਾ ਚਾਹੀਦਾ ਤਾਂ ਜੋ ਜਲਦੀ ਵਾਪਸ ਕਰ ਸਕਣ ਅਤੇ ਉਹਨਾਂ ਨੂੰ ਇਹਦੇ ਵਿੱਚ ਫਾਇਦਾ ਦਿਖੇ ਉਹਨਾਂ ਨੂੰ ਆਪਣਾ ਖੁਦ ਦਾ ਰੁਜ਼ਗਾਰ ਸ਼ੁਰੂ ਕਰਨ ਦੀ ਵੀ ਉਹਨਾਂ ਵਿੱਚ ਭਾਵਨਾ ਜਗਾਈ ਜਾਵੇ ਅਤੇ ਲੋਕਾਂ ਨੂੰ ਉਹਦੇ ਬਾਰੇ ਵੱਧ ਤੋਂ ਵੱਧ ਜਿਹੜਾ ਉਹ ਕੰਮ ਕਰਨਾ ਚਾਹੁੰਦੇ ਉਹਨਾਂ ਨੂੰ ਜਾਣਕਾਰੀ ਫ੍ਰੀ 'ਚ ਦਿੱਤੀ ਜਾਵੇ ਜਾਂ ਫਿਰ ਉਹ ਮੁਰਗੀ ਪਾਲਣਾ ਹੋਵੇ ਜਾਂ ਫਿਰ ਉਹ ਕੋਈ ਦੁਕਾਨ ਦੁਕਾਨ ਹੀ ਉਸ ਨੇ ਖੋਲ੍ਹਣੀ ਹੋਵੇ ਉਸ ਲਈ ਫ੍ਰੀ 'ਚ ਕੈਂਪ ਲਗਾਏ ਜਾਣ ਤਾਂ ਜੋ ਅੱਗੇ ਵਾਲੀ ਪੀੜ੍ਹੀ ਨੂੰ ਵੀ ਆ ਉਹ ਉਹਨਾਂ ਨੂੰ ਵੀ ਅਸਾਨ ਹੋਵੇ ਉਹਨਾਂ ਨੂੰ ਵੀ ਕੋਈ ਜਾਣਕਾਰੀ ਦੇਣ ਵਾਲਾ ਹੋਵੇ ਵੀ ਆਹ ਕੰਮ ਐਵੇਂ ਚੱਲਣਾ ਚਾਹੀਦਾ ਕਿਉਂਕਿ ਸ਼ਹਿਰ ਔਰ ਪਿੰਡਾਂ ਵਿੱਚ ਦੇਖਿਆ ਜਾਵੇ ਤਾਂ ਬਹੁਤ ਅੰਤਰ ਹੈ ਸ਼ਹਿਰਾਂ ਵਿੱਚ ਰੋਜ਼ ਟਰੈਂਡ ਚੇਂਜ ਹੁੰਦੇ ਪਰ ਪਿੰਡਾਂ ਵਿੱਚ ਨਹੀਂ ਹੈ ਪਿੰਡਾਂ ਵਿੱਚ ਨੋਰਮਲੀ ਇੱਕ ਹੀ ਚੱਲਦਾ ਕਿਉਂਕਿ ਸ਼ਹਿਰਾਂ ਵਿੱਚ ਜਿਹੜੇ ਕਿ ਲੋਕ ਆਪਸ ਵਿੱਚ ਜ਼ਿਆਦਾ ਮਿਲਦੇ ਜੁਲਦੇ ਆ ਤਾਂ ਜੋ ਉਹਨਾਂ ਨੂੰ ਟਰੈਂਡ ਬਾਰੇ ਤਾਂ ਜਾਣਕਾਰੀ ਦੇਣ ਵਾਲੇ ਆਪਸ ਵਿੱਚ ਬਹੁ ਜਣੇ ਹੁੰਦੇ ਪਰ ਪਿੰਡਾਂ ਵਿੱਚ ਆਪਣੇ ਦੇਖਿਆ ਜਾਵੇ ਤਾਂ ਬਹੁਤ ਘੱਟ ਜਾਣਕਾਰੀ ਦੇਣ ਨੂੰ ਮਿਲਦੇ ਆ ਕਿਉਂਕਿ ਉੱਥੇ ਕੋਈ ਪ੍ਰੋਫੈਸ਼ਨ ਨਹੀਂ ਹੁੰਦਾ ਇਸ ਲਈ ਜੋ ਕਿ ਸਰਕਾਰ ਨੂੰ ਇਸ ਲਈ ਕੋਈ ਉਪਰਾਲਾ ਕਰਨਾ ਚਾਹੀਦਾ ਹੈ